ਦੇਖੋ ਜਿਹੜਾ ਸਵਾਲ ਆ ਕਿ ਜੇ ਕੋਈ ਦੋਸਤ ਜਾਂ ਕੋਈ ਵੀ ਰਿਸ਼ਤੇਦਾਰ ਖੇਡ ਵਿੱਚ ਸਿਖਲਾਈ ਲੈਣਾ ਚਾਹੁੰਦਾ ਤਾਂ ਕਿਸ ਨਾਲ ਸਲਾਹ ਕਰੇ ਸਭ ਤੋਂ ਪਹਿਲਾਂ ਉਹ ਆਪਣੇ ਆਪ ਨਾਲ ਸਲਾਈ ਸਲਾਹ ਕਰੇ ਜਿੰਨੇ ਹੀ ਸ ਜੇ ਕਿਸੇ ਬੱਚੇ ਨੇ ਕਿਸੇ ਦਾ ਕੋਈ ਬੱਚਾ ਵਾ ਉਹ ਗੇਮ 'ਚ ਜਾਣਾ ਚਾਹੁੰਦਾ ਪਹਿਲਾਂ ਉਹ ਉਹਦੇ ਮਾਤਾ ਪਿਤਾ ਉਹਦੇ ਬੱਚੇ ਵੱਲ ਵੇਖਣ ਉਹਨੂੰ ਪੁੱਛਣ ਕਿ ਉਹਦਾ ਇੰਟਰਸਟ ਉਹਦਾ ਰੁਝਾਨ ਕਿਸ ਗੇਮ ਵੱਲ ਆ ਸਭ ਤੋਂ ਪਹਿਲਾਂ ਬੱਚੇ ਦਾ ਧਿਆਨ ਹੋਵੇ ਬੈਡਮਿੰਟਨ ਵੱਲ ਤੁਸੀਂ ਉਹਨੂੰ ਪਾ ਦਿਉ ਉਹਦੇ ਜੂਡੋ ਵੱਲ ਅਤੇ ਉਹ ਗੱਲ ਨਹੀਂ ਬਣਦੀ ਹੈ ਨਾ ਬੱਚਾ ਖੇਡਣਾ ਚਾਹੁੰਦਾ ਹੋਵੇ ਕ੍ਰਿਕਟ ਤੁਸੀਂ ਉਹਨੂੰ ਕਹਿ ਦਿਉ ਨਹੀਂ ਤੂੰ ਵਾਲੀਬਾਲ ਖੇਡ ਉਹ ਵੀ ਗੱਲ ਨਹੀਂ ਬਣਦੀ ਉਹ ਫਿਰ ਕਾਮਯਾਬ ਨਹੀਂ ਹੁੰਦਾ ਕਿਉਂਕਿ ਬੱਚੇ ਦਾ ਹਮੇਸ਼ਾ ਮਾਇੰਡ ਕਿਸੇ ਹੋਰ ਬੰਨੇ ਰਹਿਣਾ ਵਾ ਪਹਿਲਾਂ ਉਹਨੂੰ ਪੁੱਛਿਆ ਜਾਏ ਜਿਹਨੇ ਖੇਡਣਾ ਕਿ ਹਾਂ ਬਈ ਤੂੰ ਕਿਸ ਖੇਡ ਵਿੱਚ ਤੇਰਾ ਰੁਝਾਨ ਆ ਵੈਸੇ ਤਾਂ ਮਾਪਿਆਂ ਨੂੰ ਪਤਾ ਹੁੰਦਾ ਉਹਨਾਂ ਦਾ ਬੱਚਾ ਕਿਸ ਗੇਮ ਵੱਲ ਜਾਂਦਾ ਵਾ ਕਿਸ ਕਿਹੜੀ ਗੇਮ ਖੇਡਦਾ ਕਿਹੜੀ ਖੇਡ ਖੇਡਣ ਦੇ ਵਿੱਚ ਸ਼ੌਕੀਨ ਹੈਗਾ ਵਾ ਜਿੱਧਰ ਬੱਚੇ ਦਾ ਰੁਝਾਨ ਆ ਬੱਚੇ ਨੂੰ ਹਮੇਸ਼ਾ ਉਸ ਗੇਮ ਵੱਲ ਪਾਉਣਾ ਚਾਹੀਦਾ ਬਧੋ ਬਧੀ ਨਹੀਂ ਥੋਪਣਾ ਕਿ ਨਹੀਂ ਤੂੰ ਇਸ ਬੰਨੇ ਨਹੀਂ ਤੂੰ ਇਸ ਬੰਨੇ ਜਾ ਹਰ ਜਗ੍ਹਾ ਹਰ ਸ਼ਹਿਰ ਦੇ ਵਿੱਚ ਖੇਡਾਂ ਖੇਡਣ ਲਈ ਜਮਨਿਜਮ ਹਾਲ ਬਣੇ ਹੋਏ ਆ ਸਕੂਲਾਂ ਦੇ ਵਿਚ ਸੈਂਟਰ ਖੁਲ੍ਹੇ ਹੋਏ ਆ ਖੇਡਾਂ ਦੇ ਸਰਕਾਰੀ ਸਕੂਲਾਂ 'ਚ ਉੱਥੇ ਜਾਣ ਉੱਥੇ ਕੋਚਾਂ ਨਾਲ ਸਾਰੀ ਗੱਲ ਕਰਨ ਜਿਹੜੀ ਸਿਖਲਾਈ ਦੀ ਉੱਥੋਂ ਪਤਾ ਕਰਨ ਕਿ ਹਾਂ ਭਈ ਕੋਚ ਕਿੱਦਾਂ ਕੀ ਹੈਗਾ ਇਹਦਾ ਅੱਗੇ ਸਕੋਪ ਕੀ ਹੈ ਗੇਮ ਦਾ ਅੱਗੇ ਕਿੱਥੋਂ ਤੱਕ ਜਾਂਦੀ ਹੈ ਗੇਮ ਇਹ ਇਹਦਾ ਸਰਕਾਰ ਵੱਲੋਂ ਮਾਨਤਾ ਗੇਮ ਨੂੰ ਕਈ ਗੇਮਾਂ ਇਹੋ ਜਿਹੀਆਂ ਹੁੰਦੀਆਂ ਜਿਹਨਾਂ ਨੂੰ ਮਾਨਤਾ ਨਹੀਂ ਮਿਲੀ ਹੁੰਦੀ ਕਈ ਗੇਮਾਂ ਇਹੋ ਜਿਹੀਆਂ ਜਿਹਨਾਂ ਨੂੰ ਮਾਨਤਾ ਹੈਗੀ ਆ ਸਾਰੀ ਪੁੱਛ ਗਿੱਛ ਉੱਥੇ ਜਿਹੜੇ ਕੋਚ ਆ ਉਹਨਾਂ ਕੋਲ ਸਾਨੂੰ ਮਿਲ ਸਕਦੀ ਆ ਧੰਨਵਾਦ ਜੀ